ਪੰਜਾਬੀ ਭਾਸ਼ਾ ਦੀ ਤੁਲਨਾ ਹੋਰ ਭਾਸ਼ਾਵਾਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਅੰਗਰੇਜ਼ੀ ਹਿੰਦੀ ਹੁਣ ਅਸੀਂ ਪੰਜਾਬੀ ਜੋ ਭਾਸ਼ਾ ਹੈ ਇਹ ਤੁਸੀਂ ਪੰਜਾਬ ਵਿੱਚ ਬਹੁਤ ਜ਼ਿਆਦਾ ਸੁਣ ਸਕਦੇ ਹੋ ਪੜ੍ਹ ਸਕਦੇ ਹੋ ਕਿਉਂਕਿ ਜਗ੍ਹਾ ਜਗ੍ਹਾ 'ਤੇ ਹਰ ਕੋਈ ਸਾਈਨ ਵਗੈਰਾ ਸਭ ਪੰਜਾਬੀ 'ਚ ਲਿਖੇ ਹੋਏ ਹਨ ਉਹਦੇ ਥੱਲੇ ਅੰਗਰੇਜ਼ੀ 'ਚ ਵੀ ਨਾਲ ਲਿਖੇ ਹੁੰਦੇ ਹਨ ਜਿਵੇਂ ਕੀ ਹੁਣ ਪੰਜਾਬ ਜੋ ਪੰਜਾਬ ਦੇ ਜੋ ਲੋਕ ਨੇ ਉਹ ਬਾਹਰ ਵੀ ਬਹੁਤ ਜ਼ਿਆਦਾ ਗਏ ਨੇ ਜਿਵੇਂ ਕਿ ਕੈਨੇਡਾ ਔਸਟ੍ਰੇਲੀਆ ਨਿਊਜ਼ੀਲੈਂਡ ਉੱਥੇ ਵੀ ਕਈ ਗਲੀਆਂ ਬਾਜ਼ਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਪਰ ਲਿਖਤੀ ਰੂਪ ਜਿਹੜਾ ਉਹ ਅੰਗਰੇਜ਼ੀ ਦਾ ਹੁੰਦਾ ਪਰ ਉਹਦੀ ਜਿਹੜੀ ਬੋਲੀ ਹੁੰਦੀ ਹੈ ਉਹ ਪੰਜਾਬੀ ਸਟਾਈਲ ਦੀ ਹੁੰਦੀ ਹੈ ਇਸ ਕਰਕੇ ਪੰਜਾਬ ਦੀ ਜਿਹੜੀ ਭਾਸ਼ਾ ਉਹ ਹੁਣ ਸਾਰੀ ਜਗ੍ਹਾ ਹੀ ਤਕਰੀਬਨ ਚੱਲ ਰਹੀ ਹੈ ਬਾਕੀ ਫਿਰ ਵੀ ਜਿਹੜੀ ਅੰਗਰੇਜ਼ੀ ਹੈ ਉਹਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਮੈਂ ਚਾਹੁੰਦਾ ਹਾਂ ਪੰਜਾਬੀ ਭਾਸ਼ਾ ਨੂੰ ਸਾਰੇ ਬੋਲਣ ਅਤੇ ਸਿੱਖਣ ਕਿਉਂਕਿ ਪੰਜਾਬੀ ਭਾਸ਼ਾ ਬਹੁਤ ਹੀ ਕਲਚਰਲ ਪ ਹੈਗੀ ਭਾਸ਼ਾ ਹੈਗੀ ਆ ਇਹਦੇ ਵਿੱਚ ਤੁਸੀਂ ਕਾਫ਼ੀ ਕੁਛ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ ਜਿਵੇਂ ਕਿ ਵਿਆਹ ਦੇ ਸਮੇਂ 'ਤੇ ਘੋੜੀਆਂ ਸਿੱਠਣੀਆਂ ਬੜੇ ਸਾਰੇ ਗਾਣੇ ਨੇ ਚੰਗੇ ਮਾੜੇ ਇਸ ਕਰਕੇ ਪੰਜਾਬੀ ਜਿਹੜੀ ਭਾਸ਼ਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸੁਣੋ ਅਤੇ ਪੜੋ